ਵਿੱਦਿਅਕ ਦੇ ਸਬੰਧ ਵਿੱਚ ਜਿੱਥੋਂ ਤੱਕ ਮੋਹਾਲੀ ਜ਼ਿਲ੍ਹੇ ਦਾ ਸਬੰਧ ਹੈ ਮੋਹਾਲੀ ਜ਼ਿਲ੍ਹੇ ਦੇ ਵਿੱਚ ਬਹੁਤ ਸਾਰੇ ਵਿੱਦਿਅਕ ਅਦਾਰੇ ਹਨ ਜਿਨ੍ਹਾਂ ਵਿੱਚ ਸਕੂਲ ਕਾਲਜ ਯੂਨੀਵਰਸਿਟੀਆਂ ਕਿੱਤਾ ਮੁਖੀ ਸਿਖਲਾਈ ਕੇਂਦਰ ਵੀ ਹਨ ਸਕੂ ਪੜਾਈ ਦੇ ਸਬੰਧ ਵਿੱਚ ਅੱਜ ਕੱਲ੍ਹ ਜੋ ਪ੍ਰਾਈਵੇਟ ਅਦਾਰੇ ਹਨ ਉਹਨਾਂ ਦੇ ਵਿੱਚ ਜੋ ਫੀਸਾਂ ਹਨ ਉਹ ਬਹੁਤ ਜ਼ਿਆਦਾ ਹਨ ਤਕਰੀਬਨ ਤਕਰੀਬਨ ਮੋਹਾਲੀ ਦੇ ਵਿੱਚ ਸਾਰੇ ਕੋਰਸ ਜਾਂ ਵਿਸ਼ੇ ਹੈ ਜਿਹੜੇ ਉਹ ਪੜ੍ਹਾਏ ਜਾਂਦੇ ਹਨ ਜ਼ਿਆਦਾਤਰ ਇਹ ਖੇਤਰ ਨਰਸਿੰਗ ਦੇ ਸੰਬੰਧ ਵਿੱਚ ਬਹੁਤ ਜ਼ਿਆਦਾ ਚੁਣਿਆ ਜਾਂਦਾ ਹੈ ਕਿਉਂਕਿ ਇੱਥੇ ਐਜੂ ਐਜੂਕੇਸ਼ਨ ਦੇ ਜੋ ਸਾਧਨ ਹਨ ਉਹ ਬਹੁਤ ਹਨ ਅਤੇ ਆਵਾਜਾਈ ਦੀ ਸਹੂਲਤ ਵੀ ਬਹੁਤ ਹੈ ਹਰ ਇੱਕ ਪਿੰਡ ਤੋਂ ਹਰ ਇੱਕ ਸ਼ਹਿਰ ਤੋਂ ਬੱਸਾਂ ਜੋ ਹਨ ਉਹ ਮੋਹਾਲੀ ਜ਼ਿਲ੍ਹੇ ਵਿੱਚ ਐਂਟਰ ਹੁੰਦੀਆਂ ਹਨ ਜਿਸ ਕਾਰਨ ਜੋ ਬੱਚੇ ਹਨ ਉਹ ਸ਼ਹਿਰ ਦੇ ਮੋਹਾਲੀ ਸ਼ਹਿਰ ਨੂੰ ਮੁੱਖ ਰੱਖਦੇ ਹੋਏ ਕਿਉਂਕਿ ਇੱਥੇ ਹਰ ਇੱਕ ਸਹੂਲਤ ਹੈ ਹਰ ਇੱਕ ਹਰ ਇੱਕ ਸਬਜੈਕਟ ਪੜ੍ਹਾਇਆ ਜਾਂਦਾ ਹੈ ਅਤੇ ਕਿੱਤਾ ਮੁਖੀ ਜੋ ਸਿਖਲਾਈ ਕੋਰਸ ਹਨ ਉਹ ਵੀ ਹਨ ਅਤੇ ਪੜ੍ਹਾਈ ਦੇ ਨਾਲ ਨਾਲ ਪਲੇਸਮੈਂਟ ਦੀ ਸਹੂਲਤ ਵੀ ਹੈ ਜਿਸ ਕਾਰਨ ਜੋ ਵੱਖ ਵੱਖ ਪਿੰਡਾਂ ਤੋਂ ਹੋਰ ਜ਼ਿਲ੍ਹਿਆਂ ਤੋਂ ਮੋਹਾਲੀ ਵਿਖੇ ਬੱਚੇ ਸਿੱਖਿਆ ਪ੍ਰ ਪ੍ਰਾਪਤ ਕਰਨ ਲਈ ਆਉਂਦੇ ਹਨ